ਕੁਝ ਕੁ ਮਸ਼ਹੂਰ ਟੀ ਵੀ ਸ਼ੋਅ ਜੋ ਮੈਂ ਦੇਖਦਾ ਹਾਂ ਜਿਵੇਂ ਕਿ ਕ੍ਰੇਜ਼ੀ ਕੀਆ ਰੇ ਡਾਂਸ ਇੰਡੀਆ ਡਾਂਸ ਦਿਲ ਡਾਂਸ ਇੰਡੀਆ ਡਾਂਸ ਲਿਟਲ ਮਾਸਟਰ ਡਾਂਸ ਪਲੱਸ ਨੱਚ ਬੱਲੀਏ ਡਾਂਸ ਡਾਂਸ ਅਕੈਡਮੀ ਝਲਕ ਦਿਖਲਾਜਾ ਸੁਪਰ ਡਾਂਸ ਡਾਂਸ ਦੀਵਾਨੇ ਆਦਿ ਹਨ ਇਸ ਤੋਂ ਇਲਾਵਾ ਇਹਨਾਂ ਸਾਰੇ ਸ਼ੋਆਂ ਤੋਂ ਮੈਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ ਜਿਵੇਂ ਕਿ ਮੈਂ ਜੱਜਾਂ ਦੁਆਰਾ ਦੱਸੀਆਂ ਗਲਤੀਆਂ ਦਾ ਮੈਂ ਬਹੁਤ ਧਿਆਨ ਰੱਖਦਾ ਹਾਂ ਮੈਨੂੰ ਸਾਰੇ ਤਰ੍ਹਾਂ ਦੇ ਡਾਂਸ ਆਉਂਦੇ ਹਨ ਮੈਂ ਹਰ ਰੋਜ਼ ਦੋ ਘੰਟੇ ਸਵੇਰੇ ਦੋ ਘੰਟੇ ਸ਼ਾਮ ਨੂੰ ਡਾਂਸ ਕਰਦਾ ਹਾਂ ਡਾਂਸ ਕਰਦਾ ਹਾਂ ਸ਼ਾਮ ਵੇਲੇ ਮੈਂ ਡਾਂਸ ਕਰਨ ਤੋਂ ਬਾਅਦ ਛੋਟੇ ਬੱਚਿਆ ਨੂੰ ਡਾਂਸ ਸਿਖਾਉਂਦਾ ਹਾਂ ਜੋ ਕਿ ਘਰ ਤੋਂ ਬਹੁਤ ਗਰੀਬ ਗਰੀਬ ਹਨ ਮੈਂ ਉਨ੍ਹਾਂ ਤੋਂ ਕੋਈ ਪੈਸਾ ਜਾਂ ਫੀਸ ਨਹੀਂ ਲੈਂਦਾ ਉਹਨਾਂ ਨੂੰ ਖਾਣ ਪੀਣ ਲਈ ਵੀ ਕੁਝ ਦਿੰਦਾ ਹਾਂ ਮੇਰੇ ਇੱਕ ਯੂਟਿਊਬ ਚੈਨਲ ਹੈ ਇਸ ਵਿੱਚ ਤੀਹ ਹਜ਼ਾਰ ਮੈਂਬਰ ਹਨ ਅਤੇ ਮੈਂ ਹਰ ਰੋਜ਼ ਹਰ ਰੋਜ਼ ਤੀਜੇ ਦਿਨ ਡਾਂਸ ਦੀ ਇੱਕ ਵੀਡਿਓ ਅਪਲੋਡ ਕਰਦਾ ਹਾਂ ਮੇਰੇ ਸਿਖਾਏ ਹੋਏ ਬੱਚੇ ਇੰਟਰਨੈਸ਼ਨਲ ਲੈਵਲ 'ਤੇ ਜਾਂਦੇ ਹਨ ਹਿਪ ਹੋਪ ਮੇਰਾ ਮਨਪਸੰਦੀ ਦਾ ਮਨਪਸੰਦੀ ਦਾ ਮਨਪਸੰਦੀ ਦਾ ਸ਼ੋਅ ਹੈ ਮੈਂ ਬਹੁਤ ਸਾਰੇ ਖੇਤਰਾਂ ਦੇ ਡਾਂਸ ਮੁਕਾਬਲੇ ਵਿੱਚ ਜੱਜ ਵੀ ਜਾ ਜਾਂਦਾ ਹਾਂ ਵੈਸੇ ਜੇ ਮੇਰੇ ਮਨਪਸੰਦ ਉਸਤਾਦ ਦੀ ਗੱਲ ਕੀਤੀ ਜਾਵੇ ਤਾਂ ਰੋਮ ਡਿਸੂਜਾ ਮਾਈਕਲ ਜੈਕਸ਼ਨ ਆਦਿ ਹਨ ਇਹਨਾਂ ਸਭ ਤੋਂ ਮੈਂ ਡਾਂਸ ਦੇ ਬਹੁਤ ਗੁਣ ਸਿੱਖੇ ਹਨ ਜੋ ਕਿ ਮੇਰੇ ਰੋਜ਼ਾਨਾ ਜੀਵਨ ਵਿੱਚ ਕੰਮ ਆਉਂਦੇ ਹਨ ਡਾਂਸ ਕਰਕੇ ਮੈਨੂੰ ਖੁਸ਼ੀ ਮਿਲਦੀ ਹੈ ਜੇ ਕਰ ਮੈਨੂੰ ਕਿਹਾ ਜਾਵੇ ਕਿ ਕੀ ਤੂੰ ਕਿਹਾ ਜਾਵੇ ਤਾਂ ਮੈਂ ਚੌਵੀ ਘੰਟੇ ਨੱਚਦਾ ਨੱਚੀ ਜਾਵਾਂ ਮੇਰੇ ਦਿਲ ਕਰਦਾ ਮੈਂ ਵਰਲਡ ਰਿਕੋਰਡ ਬਣਾਵਾਂ